ਗਿਆਰ੍ਹਾਂ ਜਨਵਰੀ ਵੀਹ ਸੌ ਉੱਨੀ ਇੱਕ ਦਸੰਬਰ ਵੀਹ ਸੌ ਬਾਈ ਚੌਵੀ ਮਾਰਚ ਵੀਹ ਸੌ ਇੱਕ ਤੀਹ ਜੁਲਾਈ ਵੀਹ ਸੌ ਚਾਰ ਅਤੇ ਅਠਾਰ੍ਹਾਂ ਜੂਨ ਉੱਨੀ ਸੌ ਨੜੇਨਵੇਂ